ਮੈਂ ਦੋ ਵੱਖ ਵੱਖ ਮੋਬਾਇਲ ਦੇਖੇ ਜਿਹਦੇ ਵਿੱਚ ਮੈਂ ਫਸ ਗਿਆ ਹਾਂ ਮੈਂ ਖਰੀਦਣ ਤੋਂ ਪਹਿਲਾਂ ਸੁਝਾਅ ਫੈਸਲਾ ਲੈਣਾ ਚਾਹੁੰਦਾ ਹਾਂ ਕਿ ਮੈਂ ਕਿਹੜਾ ਮੋਬਾਈਲ ਲਵਾਂ ਕਿਹੜਾ ਮੋਬਾਈਲ ਮੇਰੇ ਲਈ ਸਹੀ ਰਹੂਗਾ ਅਤੇ ਜਿਹੜਾ ਮੇਰੇ ਬਜਟ ਦੇ ਵਿੱਚ ਰਹੇਗਾ ਅਤੇ ਫਿਰ ਮੈਂ ਦੋਨਾਂ ਫੋਨਾਂ ਦੇ ਫੀਚਰ ਦੇਖੇ ਅਤੇ ਫਨਾਂਸ ਦੀ ਇਨਕਮ ਦੇਖੀ ਅਤੇ ਵਿਆਜ ਦੀ ਦਰ ਦੇਖੀ ਕਿੰਨੀ ਹੈ ਅਤੇ ਫਿਰ ਮੈਂ ਸੈਮਸੰਗ ਦੇ ਫੀਚਰ ਸਾਰੇ ਚੈੱਕ ਕੀਤੇ ਫਿਰ ਮੈਂ ਆਈਫੋਨ ਦੇ ਵੀ ਫੀਚਰ ਸਾਰੇ ਚੈੱਕ ਕੀਤੇ ਜਿਹਦੇ ਵਿੱਚ ਮੈਂ ਸਾਰਾ ਆਪਣੇ ਕੰਮ ਦੀਆਂ ਚੀਜ਼ਾਂ ਵੀ ਚੈੱਕ ਕੀਤੀਆਂ ਜੋ ਮੇਰੇ ਅੱਗੇ ਕੰਮ ਆ ਸਕਣ ਮੈਂ ਸੈਮਸੰਗ ਦੇ ਵਿੱਚ ਵੀ ਇਹ ਚੀਜ਼ਾਂ ਚੈੱਕ ਕੀਤੀਆਂ ਅਤੇ ਫੀਚਰ ਚੈੱਕ ਕੀਤੇ ਸੈਮਸੰਗ ਦੇ ਸਾਰੇ ਤਾਂ ਮੈਨੂੰ ਇਸ ਵਿੱਚ ਆਪਣੇ ਫ਼ਾਇਦਾ ਜੋ ਮੈਨੂੰ ਫੋਨ ਕੰਮ ਵਿੱਚ ਫ਼ਾਇਦਾ ਦੇਵੇ ਮੈਂ ਉਹ ਫੋਨ ਦੇ ਫੀਚਰ ਸਾਰੇ ਚੈੱਕ ਕਰਕੇ ਮੈਂ ਸੈਮਸੰਗ ਨੂੰ ਟਵੈਂਟੀ ਵੰਨ ਨੂੰ ਫਾਈਨਲ ਕੀਤਾ ਜੋ ਮੇਰੇ ਲਈ ਬਹੁਤ ਵਧੀਆ ਅਤੇ ਮੇਰੇ ਲਈ ਲਾਭਦਾਇਕ ਸੀ ਜੋ ਮੇਰੀ ਇਨਕਮ ਦੇ ਵਿੱਚ ਬਜਟ ਵਿੱਚ ਵੀ ਆ ਰਿਹਾ ਸੀ ਜੋ ਮੇਰੇ ਇਨਕਮ ਦੀ ਬਜਟ ਵਿੱਚ ਵੀ ਆ ਰਿਹਾ ਸੀ ਜੋ ਮੈਂ ਸੈਂਡ 'ਤੇ ਸੈਮਸੰਗ ਟਵੈਂਟੀ ਵੰਨ ਫਾਈਨਲ ਕਰ ਦਿੱਤਾ